ਅਸੀਂ ਮੰਨਦੇ ਹਾਂ ਕਿ ਤਕਨਾਲੋਜੀ ਅਤੇ ਇਸ ਦੀ ਅਰਜ਼ੀ ਬਾਰੇ ਲੀਅਰਿੰਗ ਕਰਨਾ ਸਭ ਲਈ ਅਧਿਐਨ ਦਾ ਵਿਸ਼ਾ ਹੋਣਾ ਚਾਹੀਦਾ ਹੈ ਅਧਿਐਨ ਦਾ ਵਿਸ਼ਾ ਇਸ ਕਰਕੇ ਹੋਣਾ ਚਾਹੀਦਾ ਹੈ ਸਾਨੂੰ ਹਰ ਚੀਜ਼ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤਕਨਾਲੋਜੀ ਨੇ ਇੰਨੀਆਂ ਸਾਰੀਆਂ ਖੋਜਾਂ ਕਰ ਲਈਆਂ ਹਨ ਕਿ ਜਿੱਦਾਂ ਮੋਬਾਇਲ ਹੈ ਐਪ ਕੰਪਿਊਟਰ ਹੈ ਇਹ ਲਿੱਕ ਲੈਪਟੌਪ ਹੈ ਜਿਸ ਤਰ੍ਹਾਂ ਅਸੀਂ ਲੈਪਟੌਪ ਨੂੰ ਹਰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾ ਸਕਦੇ ਹਾਂ ਸੈਟੇਲਾਈਟਸ ਨੇ ਜਾਂ ਨਿੱਜੀ ਕੰਪਨੀ ਤੋਂ ਸੁਪਰ ਕੰਪਿਊਟਰ ਤੋਂ ਇੱਕ ਨਿੱਜੀ ਕੰਪਿਊਟਰ ਬੋਸ ਜਾਂ ਦੋਸਤ ਤੋਂ ਬੋਸ ਜਨਮ ਤੋਂ ਮੌਤ ਤੱਕ ਤਕਨਾਲੋਜੀ ਨੇ ਸਾਡੀ ਜ਼ਿੰਦਗੀ ਦੇ ਹਰ ਕਣ ਨੂੰ ਜੋੜਨ ਵਿੱਚ ਇੱਕ ਵਿਸ਼ੇਸ਼ ਆਸਾਨ ਭੂਮਿਕਾ ਨਿਭਾ ਰਹੀ ਹੈ ਤਕਨਾਲੋਜੀ ਬਹੁਤ ਹੀ ਫਸਟ ਕੰਮ ਕਰ ਰਹੀ ਹੈ ਉੱਚੇ ਪੱਧਰ 'ਤੇ ਕੰਮ ਚੱਲ ਰਿਹਾ ਹੈ ਵਿਗਿਆਨੀ ਬਹੁਤ ਹੀ ਸਚੁੱਜੇ ਢੰਗ ਨਾਲ ਆਪਣੇ ਦਿਮਾਗ ਦੀ ਵਰਤੋਂ ਕਰਕੇ ਤਕਨਾਲੋਜੀ ਨੂੰ ਅੱਗੇ ਵੱਲ ਲਿਜਾ ਰਹੇ ਹਨ ਲੇਅਰਿੰਗ ਬਾਏ ਲੇਅਰਿੰਗ ਉਹ ਆਪਣਾ ਜਿਹੜਾ ਵੀ ਕੋਈ ਜੀ ਕੋਂਪਨੀ ਆਪਣਾ ਮਟੀਰੀਅਲ ਤਿਆਰ ਕਰਦੀ ਹੈ ਉਸ ਨੂੰ ਬੜੇ ਹੀ ਚੰਗੇ ਢੰਗ ਨਾਲ ਲੋਕਾਂ ਅੱਗੇ ਪੇਸ਼ ਕਰਦੀ ਹੈ ਅਤੇ ਬਹੁਤ ਹੀ ਸਮਾਂ ਘੱਟ ਲੱਗਦਾ ਹੈ ਧੰਨਵਾਦ